ਪੰਜਾਬ ਜੋ ਕਿ ਇੱਕ ਸਾਡਾ ਸੱਭਿਆਚਾਰਕ ਅਤੇ ਸਮਾਜਿਕ ਸਮਾ ਵਾਤਾਵਰਨ ਨੂੰ ਸੰਭਾਲ ਕੇ ਰੱਖਣ ਵਾਲਾ ਹੈ ਅਤੇ ਇਹੋ ਸੰਭਾਲੀਆਂ ਹੋਈਆਂ ਪਰੰਪਰਾਵਾਂ ਸਾਡੀਆਂ ਅਗਲੀਆਂ ਪੀੜ੍ਹੀਆਂ ਤੱਕ ਜਾਂਦੀਆਂ ਹਨ ਅਤੇ ਇਹ ਕਿਵੇਂ ਜਾਂਦੀਆਂ ਹਨ ਕਿ ਜਿਹੜੀ ਅਸੀਂ ਇੱਕ ਦੂਜੇ ਦੇ ਨਾਲ ਆਪਣੇ ਭਾਵ ਸਾਂਝੇ ਕਰਦੇ ਹਾਂ ਅਤੇ ਭਾਵ ਸਾਂਝੇ ਕਰਨ ਦੇ ਸਾਡੇ ਸਾਧਨ ਵੱਖਰੇ ਵੱਖਰੇ ਹਨ ਇਹਨਾਂ ਸਾਧਨਾਂ ਦੇ ਵਿੱਚ ਅਸੀਂ ਅੱਜ ਜੇ ਗੱਲ ਕਰੀਏ ਤਾਂ ਸਾਡੇ ਲੋਕ ਗੀਤ ਹਨ ਸਾਡੇ ਮੇਲੇ ਤਿਉਹਾਰ ਹਨ ਸਾਡੀਆਂ ਜਿਹੜਾ ਵੱਖਰਾ ਰੂਪ ਇੱਕ ਗਜ਼ਲ ਹੈ ਉਹ ਹੈ ਕਿ ਜਿਹਦੇ ਨਾਲ ਅਸੀਂ ਆਪਣੇ ਮਨ ਦੇ ਭਾਵ ਇਹਨਾਂ ਲੋਕ ਗੀਤਾਂ ਦੇ ਵਿੱਚ ਹੁੰਦੇ ਹਨ ਅਤੇ ਉਹ ਸਾਡੀਆਂ ਪੀੜ੍ਹੀ ਦਰ ਪੀੜ੍ਹੀ ਇਹ ਵਿਕਸਿਤ ਹੁੰਦੇ ਹਨ ਕਿਵੇਂ ਜੇ ਕਿਉਂਕਿ ਜਿਹੜੇ ਵੀ ਲੋਕ ਗੀਤ ਹਨ ਉਹਨਾਂ ਦਾ ਕੋਈ ਰਚਨਹਾਰ ਨਹੀਂ ਹੁੰਦਾ ਉਹਨਾਂ ਨੂੰ ਕਿਵੇਂ ਲਿਖਿਆ ਜਾਂਦਾ ਹੈ ਉਹਦੇ ਲਿਖਣ ਵਾਲੇ ਲੋਕ ਹੀ ਹੁੰਦੇ ਹਨ ਲੋਕ ਹੀ ਉਹਨਾਂ ਨੂੰ ਲਿਖਦੇ ਹਨ ਅਤੇ ਲੋਕਾਂ ਦੇ ਦੁਆਰਾ ਹੀ ਉਹ ਗਾਏ ਜਾਂਦੇ ਹਨ ਅਤੇ ਇਸ ਤਰ੍ਹਾਂ ਹੀ ਅੱਗੇ ਤੋਂ ਅੱਗੇ ਇਹ ਪੀੜ੍ਹੀ ਦਰ ਪੀੜ੍ਹੀ ਸਫ਼ਰ ਕਰਦੇ ਹਨ ਇਸ ਤਰ੍ਹਾਂ ਜੇ ਅਸੀਂ ਮੇਲੇ ਤਿਉਹਾਰਾਂ ਦੀ ਗੱਲ ਕਰੀਏ ਤਾਂ ਉਹ ਵੀ ਸਾਰੇ ਜਦੋਂ ਇਕੱਠੇ ਰਲ ਮਿਲ ਕੇ ਮੇਲੇ ਤਿਉਹਾਰਾਂ 'ਤੇ ਜਾਂਦੇ ਹਨ ਤਾਂ ਉਹ ਵੀ ਉਹਨਾਂ ਦੇ ਮਨ ਪਰਚਾਵੇ ਦਾ ਸਾਧਨ ਬਣਦੇ ਹਨ ਅਤੇ ਇਸ ਤਰ੍ਹਾਂ ਹੀ ਇਹ ਸਾਡੀ ਸੱਭਿਆਚਾਰਕ ਅਤੇ ਸਮਾਜਿਕ ਸਾਂਝ ਬਣੀ ਰਹਿੰਦੀ ਹੈ